ਵਿਆਹ ਸਮਾਗਮਾਂ ਵਿੱਚ ਪਾਣੀ ਦਾ ਬੱਚਤ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨਾਂ ਸਮਾਗਮਾਂ ਵਿੱਚ ਬੇਹੱਦ ਪਾਣੀ ਵਰਤਿਆ ਜਾਂਦਾ ਹੈ ਸਭ ਤੋਂ ਪਹਿਲਾਂ ਪੀਣ ਯੋਗ ਪਾਣੀ ਦੀ ਵਿਅਰਥ ਖਪਤ ਨੂੰ ਘਟਾਉਣ ਲਈ ਵੱਡੇ ਡਿਸਪੈਸ ਹੋਣੀ ਚਾਹੀਦੀ ਤਾਂ ਜੋ ਹਰ ਵਿਅਕਤੀ ਆਪਣੀ ਲੋੜ ਅਨੁਸਾਰ ਹੀ ਪਾਣੀ ਲਵੇ ਭੋਜਨ ਬਣਾਉਣ ਦੌਰਾਨ ਵੀ ਪਾਣੀ ਦੀ ਬੱਚਤ ਕਰਨ ਲਈ ਬਰਗੇ ਹੋਏ ਪਾਣੀ ਨੂੰ ਦੁਬਾਰਾ ਵਰਤਣਾ ਚਾਹੀਦਾ ਹੈ ਜਿਵੇਂ ਕਿ ਸਬਜ਼ੀਆਂ ਧੋਣ ਤੋਂ ਬਾਅਦ ਬਚਿਆ ਪਾਣੀ ਪੌਦਿਆਂ ਨੂੰ ਸਿੰਚਣ ਲਈ ਵਰਤਿਆ ਜਾ ਸਕਦਾ ਹੈ ਇਲਾਵਾ ਵਿਆਹਾਂ ਵਿੱਚ ਡਿਸਪੋਜਲ ਵਰਤਣ ਦੀ ਬਜਾਏ ਮੁੜ ਵਰਤਣਯੋਗ ਬਰਤਨ ਵਰਤਣੇ ਚਾਹੀਦੇ ਹਨ ਤਾਂ ਜੋ ਧੋਣ ਸਮੇਂ ਵੀ ਪਾਣੀ ਦੀ ਬੱਚਤ ਹੋ ਸਕੇ ਵਿਅਰਥ ਵਗਦੇ ਨਲਕਿਆਂ ਨੂੰ ਬੰਦ ਰੱਖਣਾ ਅਤੇ ਸੁੱਕੀ ਸਫਾਈ ਨੂੰ ਤਰਜੀਹ ਦੇਣਾ ਵੀ ਇੱਕ ਵਧੀਆ ਵਿਕਲਪ ਹੈ ਮਹਿਮਾਨਾਂ ਨੂੰ ਵੀ ਪਾਣੀ ਦੀ ਮਹਿਤਾ ਬਾਰੇ ਜਾਗਰੂਕ ਕੀਤਾ ਜਾ ਸਕਦਾ ਹੈ ਜਿਸ ਲਈ ਵਿਆਹ ਸਥਾਨ ਉੱਤੇ ਜਾਣਕਾਰੀ ਬੋਰਡ ਜੀ ਲਗਾਏ ਜਾ ਸਕਦੇ ਹਨ ਜੇਕਰ ਇਹ ਸਾਰੇ ਉਪਰਾਲੇ ਅਪਣਾਏ ਜਾਣ ਤਾਂ ਵਿਆਹ ਸਮਰੋਹ ਪਿਆਰੀਆਂ ਜ਼ਿਆਦਾ ਦੇ ਨਾਲ ਨਾਲ ਵਾਤਾਵਰਣ ਦੇ ਲਈ ਕੀ ਫਾਇਦੇ ਬਣ ਬਣ ਸਕਦੇ ਹਨ